ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਟੱਚਸਟੋਨ ਮੋਹਾਲੀ ਤੋਂ ਗੱਲ ਕਰ ਰਹੀ ਹਾਂ ਹਾਂਜੀ ਅੱਛਾ ਅਤੇ ਤੁਸੀਂ ਕੈਨੇਡਾ ਲਈ ਮਾਸਟਰਸ ਦਾ ਕੋਰਸ ਲੈਣਾ ਚਾਹੁੰਦੇ ਹੋ ਰਾਈਟ ਠੀਕ ਹੈ ਐਕਚੂਅਲੀ ਅਗਰ ਤੁਸੀਂ ਕਾਲਜ ਲੈਵਲ 'ਤੇ ਤੁਸੀਂ ਐਪਲਾਈ ਕਰਨਾ ਚਾਹੁੰਦੇ ਹੋ ਪੜ੍ਹਾਈ ਲਈ ਤਾਂ ਤੁਹਾਨੂੰ ਸਾਢੇ ਛੇ ਬੈਂਡ ਦੀ ਰਿਕੁਆਇਰਮੈਂਟ ਹੈ ਗ੍ਰੈਜੂਏਸ਼ਨ ਤੋਂ ਬਾਅਦ ਪਰ ਜੇ ਤੁਸੀਂ ਯੂਨੀਵਰਸਿਟੀ ਲੈਵਲ ਦੇ ਲਈ ਐਪਲਾਈ ਕਰਨਾ ਚਾਹੁੰਦੇ ਹੋ ਤਾਂ ਥੋ ਤੁਹਾਡੀ ਬੈਂਡ ਰਿਕੁਆਇਰਮੈਂਟ ਥੋੜ੍ਹੀ ਜਿਹੀ ਵੱਧ ਜੇਗੀ ਤਾਂ ਸੱਤ ਬੈਂਡ ਤੁਹਾਡੇ ਚਾਹੀਦੇ ਹੋਣਗੇ ਫੀਸ ਸਾਡੀ ਵੈਸੇ ਅਸੀਂ ਅੱਠ ਹਜ਼ਾਰ ਰੁਪਈਆ ਚਾਰਜ਼ ਕਰਦੇ ਹਾਂ ਬੱਚਿਆਂ ਤੋਂ ਪਰ ਹੁਣ ਫੈਸਟੀਵਲ ਸੀਜ਼ਨ ਕਰਕੇ ਥੋੜ੍ਹਾ ਜਿਹਾ ਡਿਸਕਾਊਂਟ ਵੀ ਚੱਲ ਰਿਹਾ ਹੈ ਬਾਕੀ ਅਸੀਂ ਤੁਹਾਨੂੰ ਪਰੋਪਰ ਗਾਈਡ ਕਰ ਦਾਂਗੇ ਕਿੱਦਾਂ ਪੜ੍ਹਾਈ ਹੈ ਹੈਨਾ ਕੀ ਮੋਡੀਊਲ ਹੈ ਕੀ ਤੁਹਾਡਾ ਟਾਈਮ ਰਹੇਗਾ ਅਤੇ ਤੁਸੀਂ ਕਿੰਨੇ ਦਿਨ ਆਉਣਾ ਹੈ ਹਫ਼ਤੇ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਬੈਚ ਦੀ ਰਿਕੁਆਇਰਮੈਂਟ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਵਾਂਗੇ ਠੀਕ ਹੈ ਜੀ ਉਹਦੇ ਲਈ ਤੁਸੀਂ ਸਾਡੇ ਔਫ਼ਿਸ ਵਿਜ਼ਿਟ ਕਰੋਗੇ ਓਕੇ